ਮੈਂ ਖਾਣਾ ਬਣਾਉਣਾ ਚੌਦ੍ਹਾਂ ਸਾਲ ਦੀ ਉਮਰ ਵਿੱਚ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਮੇਰੇ ਮੰਮੀ ਇਕੱਲੇ ਹੀ ਹੈ ਤੋਂ ਥੋੜ੍ਹਾ ਬਿਮਾਰ ਜਿਹੇ ਰਹਿੰਦੇ ਹੈ ਤਾਂ ਮੈਂ ਛੋਟੀ ਹੁੰਦੀ ਮਤਲਬ ਖਾਣਾ ਬਣਾਉਣਾ ਸਿੱਖ ਗਈ ਸੀ ਖਾਣਾ ਪਹਿਲੇ ਅਸੀਂ ਚੁੱਲ੍ਹੇ 'ਤੇ ਬਣਾਉਂਦੇ ਸੀ ਹੁਣ ਅਸੀਂ ਗੈਸ 'ਤੇ ਬਣਾਉਂਦੇ ਹਾਂ ਲੇਕਿਨ ਜੋ ਸੁਆਦ ਚੁੱਲ੍ਹੇ ਦੇ ਖਾਣੇ ਦਾ ਹੈ ਉਹ ਗੈਸ ਦੇ ਖਾਣੇ ਦਾ ਹੈ ਨਹੀਂ ਬਿਲਕੁਲ ਵੀ ਉਹ ਮਤਲਬ ਬਹੁਤ ਵਧੀਆ ਸੁਆਦ ਬਹੁਤ ਵਧੀਆ ਹੁੰਦੀ ਚੁੱਲ੍ਹੇ ਦੇ ਖਾਣੇ ਦੀ ਗੈਸ ਦੀ ਤਾਂ ਬਸ ਐਵੇਂ ਹੀ ਐਵੇਂ ਰੋਟੀ ਛੇਤੀ ਛੇਤੀ ਪੱਕ ਜਾਂਦੀ ਹੈ ਉਹ ਇੰਨਾਂ ਸੁਆਦ ਨਹੀਂ ਲੱਗਦਾ ਜਿੰਨਾਂ ਕਿ ਉਹ ਗੈਸ 'ਤੇ ਚੁੱਲ੍ਹੇ ਦਾ ਲੱਗਦਾ ਹੈ ਸਾਨੂੰ ਗੈਸ ਦਾ ਤਾਂ ਬਸ ਐਵੇਂ ਹੀ ਹੈ ਵੀ ਫਟਾਫਟ ਬਸ ਚਾਹ ਬਣਾਉਣ ਵਾਸਤੇ ਹੈ ਜੇ ਚੁੱਲ੍ਹੇ 'ਤੇ ਖਾਣਾ ਬਣਦਾ ਹੈ ਉਹਦਾ ਸੁਆਦ ਕੁਛ ਔਰ ਹੀ ਹੁੰਦਾ ਹੈ ਸਾਨੂੰ ਤਾਂ ਅੱਗੇ ਬੈਠ ਕੇ ਠੰਡੀਆਂ ਵਿੱਚ ਬੈਠ ਕੇ ਚੁੱਲ੍ਹੇ ਦੇ ਸਾਹਮਣੇ ਰੋਟੀ ਬਣਾਓ ਅਤੇ ਅੱਗ ਸੇਕੀ ਜਾਓ ਸਾਰੇ ਉੱਥੇ ਹੀ ਬੈਠ ਜਾਂਦੇ ਹੈ ਫਿਰ ਕੋਈ ਸਾਰੇ ਰਜਾਈ ਛੱਡ ਛੱਡ ਕੇ ਚੁੱਲ੍ਹੇ ਦੇ ਕੋਲ ਹੀ ਬਹਿ ਜਾਂਦੇ ਹਾਂ ਉ ਬਹੁਤ ਵਧੀਆ ਲੱਗਦਾ ਹੈ ਵੀ ਗਰਮ ਗਰਮ ਬਣਾਓ ਅਤੇ ਗਰਮ ਗਰਮ ਖਾਓ ਸਾਗ ਸੂਗ ਸਭ ਚੁ ਕੁਛ ਅਸੀਂ ਚੁੱਲ੍ਹੇ 'ਤੇ ਹੀ ਬਣਾਉਂਦੇ ਹਾਂ ਅਸੀਂ ਕਦੇ ਕਦੇ ਤਾਂ ਕਦੇ ਕਦੇ ਕਿਆ ਹੁਣ ਤਾਂ ਜ਼ਿਆਦਾਤਰ ਲੋਕ ਗੈਸ 'ਤੇ ਹੀ ਬਣਾਉਂਦੇ ਹੈ ਚੁੱਲ੍ਹਾ ਤਾਂ ਸਾਰਿਆਂ ਨੇ ਛੱਡ ਹੀ ਦਿੱਤਾ ਹੈ